ਹਾਂਜੀ ਤੁਸੀਂ ਫਲਿੱਪਕਾਰਟ ਤੋਂ ਬੋਲ ਰਹੇ ਜੀ ਅਸੀਂ ਵੋਸ਼ਿੰਗ ਮਸ਼ੀਨ ਖਰੀਦੀ ਸੀ ਜੀ ਅਤੇ ਉਹਦੀ ਪੈਕਿੰਗ ਵਗੈਰਾ ਬਹੁਤ ਵਧੀਆ ਸੀ ਅਤੇ ਬਹੁਤ ਅੱਛੇ ਉਹਦੇ ਫੰਕਸ਼ਨ ਨੇ ਅਤੇ ਟਾਈਮ ਵੀ ਵਧੀਆ ਬੱਚਤ ਹੋ ਰਹੀ ਹੈ ਮੇਰੀ ਅਤੇ ਵਧੀਆ ਭਾਰੀ ਕੱਪੜੇ ਬਹੁਤ ਵਧੀਆ ਤਰੀਕੇ ਨਾਲ਼ ਵਾਸ਼ ਹੋ ਰਹੇ ਨੇ ਅਤੇ ਫਾਈਵ ਆਊਟ ਆਫ਼ ਫਾਈਵ ਨੰਬਰ ਦਿੰਦੀ ਇਹ ਨੂੰ